ਭਾਰਤ ਦੇ ਜਿਹੜੇ ਲੋਕ ਨੇ ਉਹ ਖਾਣ ਪੀਣ ਦੇ ਬੜੇ ਸ਼ੌਕੀਨ ਨੇ ਇਹ ਬੜਾ ਰੱਜ ਕੇ ਖਾਂਦੇ ਪੀਂਦੇ ਆ ਅਤੇ ਜਿਵੇਂ ਕਿ ਬੇਸਿਕਲੀ ਮੈਂ ਜਿਹੜਾ ਹੈ ਪੰਜਾਬ ਤੋਂ ਰਹਿਣ ਵਾਲਾ ਹੈਗਾ ਅਤੇ ਪੰਜਾਬ ਵਾਲੇ ਤਾਂ ਹੋਰ ਵੀ ਖਾਣ ਪੀਣ ਦੇ ਬੜੇ ਸ਼ੌਕੀਨ ਨੇ ਖੁੱਲ੍ਹਾ ਖਾਣਾ ਪੀਣਾ ਹੈ ਇਹਨਾਂ ਦਾ ਅਤੇ ਸਵੇਰ ਦਾ ਜਿਹੜਾ ਸ਼ੁਰੂਆਤ ਆ ਖਾਣੇ ਦੀ ਇਹਨਾਂ ਦਾ ਜਿਹੜਾ ਹੈ ਸੁਬਾਹ ਤੱਕ ਬ੍ਰੇਕਫਾਸਟ ਆ ਉਹ ਬੜੇ ਹੈਵੀ ਹੁੰਦਾ ਗਾ ਸਵੇਰ ਦੇ ਪਰੌਂਠੇ ਜਾਂ ਆਲੂ ਵਾਲੇ ਪਰੌਂਠੇ ਖਾਣੇ ਜਾਂ ਵੈਸੇ ਰੋਜ਼ ਪਰੌਂਠੇ ਖਾਣੇ ਇਹਨਾਂ ਦਾ ਡੇਲੀ ਦਾ ਬ੍ਰੇਕਫਾਸਟ ਬੜਾ ਭਾਰੀ ਹੁੰਦਾ ਗਾ ਫੇਰ ਦੁਪਹਿਰੇ ਰੋਟੀ ਖਾਣੀ ਰੱਜ ਕੇ ਸ਼ਾਮੀ ਫੇਰ ਜਿਹੜੀ ਹੈਗੀ ਆ ਹੈਵੀ ਡਿਨਰ ਕਰਨਾ ਤਾਂ ਤਿੰਨ ਟੈਮ ਤਾਂ ਇਹ ਜਿਹੜਾ ਹੈਗਾ ਗਾ ਖਾਣਾ ਖਾਂਦੇ ਅਤੇ ਕਾਫੀ ਜ਼ਿਆਦਾ ਜਿਹੜਾ ਹੈ ਖਾਣਾ ਉਹ ਖਾਇਆ ਜਾਂਦਾ ਹੈਗਾ ਜਾਂ ਐਂ ਕਹਿ ਲਉ ਵੱਖੋਂ ਵੱਖ ਤਰ੍ਹਾਂ ਦਾ ਪਕਵਾਨ ਜਿਹੜੇ ਖਾਧੇ ਜਾਂਦੇ ਨੇ ਅਤੇ ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਜਿਹੜਾ ਹੈ ਪੰਜਾਬੀਆਂ ਦਾ ਖਾਣ ਪੀਣ ਦੀ ਗੱਲ ਮੌਸਮ ਦੇ ਅਨੁਸਾਰ ਜਿਹੜੀਆਂ ਹੈਗੀਆਂ ਨੇ ਸਬਜ਼ੀਆਂ ਵਗੈਰਾ ਉਹ ਖਾਂਦੇ ਨੇ ਹੁਣ ਜਿਵੇਂ ਸਰਦੀਆਂ ਦਾ ਸਮਾਂ ਹੈ ਸਰਦੀਆਂ ਵਿੱਚ ਸਰ੍ਹੋਂ ਦਾ ਸਾਗ ਹੋ ਗਿਆ ਮੱਕੀ ਦੀ ਰੋਟੀ ਅਤੇ ਜਿਹੜਾ ਹੈ ਨਾਲ ਲੱਸੀ ਹੋ ਗਈ ਆ ਮੱਖਣ ਹੋ ਗਿਆ ਅਤੇ ਇਹਨੂੰ ਤਾਂ ਭੱਜ ਕੇ ਹਰ ਇੱਕ ਪੰਜਾਬੀ ਦੇ ਮੂੰਹ 'ਚ ਲਾਹਲ ਆ ਜਾਂਦੀਆਂ ਨੇ ਤਾਂ ਇਹ ਤਾਂ ਜਿਹੜੇ ਹੈਗੇ ਨੇ ਹਰ ਇੱਕ ਪੰਜਾਬੀ ਦਾ ਫੇਵਰੇਟੜ ਜਿਹੜਾ ਹੈ ਪਸੰਦੀਦਾ ਪਕਵਾਨ ਦੇ ਵਿੱਚ ਆਉਂਦਾ ਹੈ ਮਸਾਲਿਆਂ ਦੀ ਗੱਲ ਮਸਾਲਿਆਂ ਦੇ ਵੀ ਬੜੇ ਸ਼ੌਕੀਨ ਅਸੀਂ ਪੰਜਾਬੀ ਤਾਂ ਮਸਾਲਿਆਂ ਦੇ ਵਿੱਚ ਤਾਂ ਜਿਹੜੇ ਹੈ ਰੱਜ ਕੇ ਮਸਾਲੇ ਪਾਏ ਜਾਂਦੇ ਨੇ ਨੂਣ ਮਿਰਚ ਹਲਦੀ ਗਰਮ ਮਸਾਲਾ ਅਤੇ ਇਹਨਾਂ ਤੋਂ ਬਿਨਾ ਤਾਂ ਕੋਈ ਸਬਜ਼ੀ ਬਣਦੀ ਹੀ ਨਹੀਂ ਹੈਗੀ ਹਰ ਇੱਕ ਜਿਹੜੀ ਹੈਗੇ ਨੇ ਪਕਵਾਨ ਦੇ ਵਿੱਚ ਭਾਵੇਂ ਸਵੇਰ ਦਾ ਭੋਜਨ ਆ ਭਾਵੇਂ ਦੁਪਹਿਰ ਦਾ ਭਾਵੇਂ ਰਾਤ ਦਾ ਹਰ ਇੱਕ ਪਕਵਾਨ ਦੇ ਵਿੱਚ ਜਿਹੜਾ ਹੈ ਮਸਾਲੇ ਤਾਂ ਠੂਸ ਠੂਸ ਕੇ ਪਾਏ ਜਾਂਦੇ ਨੇ